ਔਰਤਾਂ ਨੂੰ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਕਈ ਸਾਰੀਆਂ ਚੀਜ਼ਾਂ ਸੁਣਨ ਵਿੱਚ ਆਈਆਂ ਕਿ ਕੁੜੀਆਂ ਨੂੰ ਇਨਇਕੁਐਲੀਟੀਸ ਦੇਖਣੀ ਪੈਂਦੀ ਹੈ ਜਿਹਦੇ ਕਰਕੇ ਕਿ ਉਹ ਉਹਨਾਂ ਦਾ ਉਹ ਸੋਸ਼ਲਾਈਜ ਨਹੀਂ ਕਰ ਸਕਦੀਆਂ ਉਹ ਪੜ੍ਹ ਨਹੀਂ ਸਕਦੀਆਂ ਉਹ ਕਿਤੇ ਬਾਹਰ ਜਾ ਨਹੀਂ ਸਕਦੀਆਂ ਅਤੇ ਉਹ ਬਸ ਘਰ ਹੀ ਰਹਿ ਸਕ ਰਹਿ ਸਕਦੀਆਂ ਹਨ